ਹੈਲੋ ਸਾਹਿਲ ਕੀ ਕਰ ਰਿਹਾ ਵਾ ਅੱਛਾ ਯਾਰ ਇਕ ਕੰਮ ਹੈਗਾ ਤੇਰੇ ਤੋਂ ਕੱਲ ਕੰਮ ਹੈਗਾ ਤੇਰੇ ਤੋਂ ਕੱਲ ਇੱਕ ਮਤਲਬ ਇੱਕ ਕੱਲ ਨੂੰ ਤੈਨੂੰ ਇਕ ਥੋੜਾ ਜਿਹਾ ਐਕਸਟਰਾ ਕੰਮ ਕਰਨਾ ਪੈਣਾ ਕੱਲ ਮੇਰੇ ਨਾ ਘਰੇ ਇੱਕ ਗੈਸਟ ਜਿਹਾ ਕੱਲ ਥੋੜੇ ਜਿਹੇ ਗੈਸਟ ਜੀ ਆ ਰਹੇ ਨੇ ਮੇਰੇ ਤਾਂ ਫਿਰ ਉਹਨਾਂ ਲਈ ਹਾਊਸ ਕਲੀਨ ਵਗੈਰਾ ਹਾਊਸ ਕਲੀਨ ਕਰਨਾ ਪੈਣਾ ਤੈਨੂੰ ਠੀਕ ਹੈ ਨਾ ਦੇ ਉਸ ਤੋਂ ਬਾਅਦ ਮੈਨੂੰ ਘਰ ਦੋ ਤਿੰਨ ਭਾ ਭਾਂਡੇ ਵਗੈਰਾ ਸੈਟ ਕਰਕੇ ਰੱਖ ਲੈਂਦੇ ਖਾਣਾ ਵਗੈਰਾ ਬਣਾ ਲੈ ਤੈਨੂੰ ਵਧੀਆ ਹਾਂ ਉਹ ਕੁਛ ਵੀ ਬਸ ਮਤਲਵ ਵੀ ਕੰਮ ਤਾਂ ਤੂੰ ਵਧੀਆ ਕਰਦਾ ਪਰ ਧਿਆਨ ਰੱਖੇ ਕੋਈ ਚੀਜ਼ ਹੋਵੇ ਨਾ ਕਿਉਕਿ ਗੈਸਟ ਜਿਹੜੇ ਹੈਗੇ ਨੇ ਉਹ ਸਪੈਸ਼ਲ ਹੈਗੇ ਨੇ ਮੇਰੇ ਖਾਣੇ ਵਿੱਚ ਤਾਂ ਜਿਹੜਾ ਆਪਾਂ ਖਾਂਦੇ ਆ ਉਹ ਨਾ ਬਣਾਈ ਕੁਛ ਵਧੀਆ ਜਿਹਾ ਬਣਾਈ ਜਿਵੇਂ ਸ਼ਾਹੀ ਪਨੀਰ ਕੜਾਈ ਪਨੀਰ ਵਗੈਰਾ ਠੀਕ ਹ ਨਾ ਕੋਈ ਵਧੀਆ ਜਿਹਾ ਚੀਰੇ ਹਾਂ ਤੇ ਮੈਂ ਕਿਹਾ ਹੋਰ ਕੋਈ ਦੇਖ ਲੈ ਜੇ ਤਾਂ ਤੈਨੂੰ ਕੋਈ ਲੱਗ ਜੇ ਤੈਨੂੰ ਲੱਗ ਰਹੀ ਵੀ ਹਾਂ ਸਹੀ ਕਰਨ ਵਾਲੀ ਆ ਉਹ ਸਹੀ ਕਰ ਫਿਰ ਜਿਹੜੇ ਆਪਣੇ ਜਿਹੜਾ ਸਟੋਰ ਰੂਮ ਹੈਗਾ ਉਹ ਵੀ ਉਹਦੀ ਵੀ ਸਾਫ ਸਫਾਈ ਕਰ ਦੀਓ ਠੀਕ ਐ ਨਾ ਬੈਡਸ਼ੀਟ ਚੇਂਜ ਕਰਦੇ ਕਿ ਕੀ ਕਾਲੀ ਆਪਾਂ ਤਾਂ ਜਦ ਮਰਜੀ ਚੇਂਜ ਕਰਲਾਂਗੇ ਪਰ ਗੈਸਟ ਨੂੰ ਵਧੀਆ ਲੱਗਣਾ ਚਾਹੀਦਾ ਨਾ ਤੇ ਰਹੀ ਗੱਲ ਪਰਦਿਆਂ ਦੀ ਪਰਦਿਆਂ ਦਾ ਥੋੜੀ ਜੀ ਸਾਫ ਸਫਾਈ ਜਿਆਦਾ ਨਹੀਂ ਬਸ

ਹਾਂ ਬਾਕੀ ਨੂੰ ਕਹਿ ਦੀ ਕੀ ਮੈਂ ਕਿਹਾ ਸੀਗਾ ਕਿ ਤੂੰ ਉਹਦੇ ਨਾਲ ਤੇਰੇ ਨਾਲ ਕਰਵਾ ਦੇਣਗੇ ਠੀਕ ਹੈ ਨਾ ਜੇਕਰ ਕੋਈ ਨਾ ਜੇਕਰ ਕੋਈ ਨਾ ਮੰਨੇ ਤਾਂ ਮੇਰੀ ਗੱਲ ਕਰਵਾ ਦੀ ਅੱਜ ਅੱਜ ਕੁਛ ਹਲਕਾ ਜਿਹਾ ਬਣਾਈ ਜਿਸ ਕੱਲ ਗੈਸਟ ਆਣਗੇ ਫਿਰ ਕੱਲ ਭਾਰੀ ਹੀ ਹੋਊਗਾ

ਨਾਹ ਕੱਲ ਕੱਲ ਲਵਾਂਗੇ ਕੱਲ ਕੱਲ ਅਸੀਂ ਤਾਂ ਰੈਗੂਲਰ ਨੇ ਐਂ ਕਰ ਅੱਜ ਮੰਗਵਾ ਕੇ ਰੱਖ ਲੈ ਕੱਲ ਖੋਲਾਂਗੇ ਠੀਕ ਐ ਨਾ ਤੇ ਗਲਾਸ ਵੀ ਥੋੜੇ ਵਧੀਆ ਜੇ ਲੈ ਕੇ ਰੱਖੀ ਕੱਪ ਕੁੱਪ ਵੀ ਤਾਂ ਕਿ ਤਾਂ ਜੇਕਰ ਚਾਹ ਵਗੈਰਾ ਉਹਦੇ ਵਿੱਚ ਹੀ ਦੇ ਦਾਂਗੇ